ਬਾਗਬਾਨੀ ਲਈ ਕਈ ਤਰ੍ਹਾਂ ਦੇ ਸੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਟਰੈਕਟਰ ਹੋ ਗਏ ਟਰੈਕਟਰ ਦੀ ਅਸੀਂ ਵਰਤੋਂ ਬਾਗਾਂ ਵਿੱਚ ਖੁਦਾਈ ਕਰਨ ਲਈ ਜ਼ਿਆਦਾ ਕਰਦੇ ਹਾਂ ਜਿਸ ਤਰ੍ਹਾਂ ਹੱਲਾਂ ਦੀ ਵਰਤੋਂ ਹੁੰਦੀ ਹੈ ਹੱਲਾਂ ਨਾਲ਼ ਪਹਿਲਾਂ ਉਹਦੀ ਖੁਦਾਈ ਕੀਤੀ ਜਾਂਦੀ ਉਹਨੂੰ ਵਾਹਿਆ ਜਾਂਦਾ ਖੇਤ ਨੂੰ ਖੇਤ ਨੂੰ ਵਾਹ ਕੇ ਉਸ ਤੋਂ ਬਾਅਦ ਅਸੀਂ ਬਰਮੇ ਦੀ ਵਰਤੋਂ ਕਰਦੇ ਹਾਂ ਬਰਮਾ ਵਰਤਿਆ ਜਾਂਦਾ ਹੈ ਕਿ ਉਹਨੂੰ ਟੋਏ ਪੁੱਟਣ ਲਈ ਟੋਇਆ ਪੁੱਟ ਕੇ ਉਹਦੇ ਵਿੱਚ ਦਰੱਖਤਾਂ ਦਾ ਲਾਉਣਾ ਰੰਬੀ ਦੀ ਵਰਤੋਂ ਕੀਤੀ ਜਾਂਦੀ ਹੈ ਰੰਬੀ ਵਰਤੀ ਜਾਂਦੀ ਹੈ ਕਿ ਬੂਟਿਆਂ ਦੀ ਖੁਦਾਈ ਕਰਨ ਲਈ ਗੁਡਾਈ ਕਰਨ ਲਈ ਕਟਰ ਕਟਰ ਵਰਤੇ ਜਾਂਦੇ ਹਨ ਜਿਸ ਤਰ੍ਹਾਂ ਅਸੀਂ ਬੂਟਿਆਂ ਦੀ ਛੰਗਾਈ ਕਰਨੀ ਹੁੰਦੀ ਹੈ ਉਹਨਾਂ ਦੇ ਲਈ ਆਰੀ ਹੋਈ ਦਾਤਰ ਹੋਇਆ ਜਾਂ ਕਟਰਾਂ ਦੀ ਵਰਤੋਂ ਕਰੀ ਜਾ ਕਰੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਅਸੀਂ ਸਪਰੇਹਾਂ ਵਾਲੀਆਂ ਮਸ਼ੀਨਾਂ ਆਉਂਦੀਆਂ ਹਨ ਜੋ ਕਿ ਸਾਰੇ ਬਾਗ ਵਿੱਚ ਉਹਦੇ ਨਾਲ਼ ਸਪਰੇਅ ਕੀਤੀ ਜਾਂਦੀ ਹੈ ਜੇ ਛੋਟੇ ਪੌਦੇ ਹੋਣ ਤਾਂ ਉਹਨਾਂ ਨੂੰ ਅਸੀਂ ਪੰਪ ਨਾਲ਼ ਹੀ ਸਪਰੇਅ ਕਰ ਸਕਦੇ ਹਾਂ ਪਰ ਜ਼ਿਆਦਾ ਚ ਜ਼ਿਆਦਾਤਰ ਜਿਹੜੇ ਜ਼ਿਆਦਾ ਕਿਲਿਆਂ ਵਿੱਚ ਬਾਗ ਹੁੰਦੇ ਹਨ ਬਾਗਬਾਨੀਆਂ ਹੁੰਦੀਆਂ ਨੇ ਉਹਨਾਂ ਨੂੰ ਮਸ਼ੀਨਾਂ ਨਾਲ਼ ਉੱਪਰ ਲਾ ਕੇ ਫਿਰ ਸਪਰੇਅ ਕੀਤੀ ਜਾਂਦੀ ਹੈ